ਸਤਿ ਸ਼੍ਰੀ ਅਕਾਲ ਮੇਰਾ ਨਾਮ ਪ੍ਰੀਆ ਹੈ ਜਿਵੇਂ ਕਿ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਤਿੰਨ ਸਿੱਖਿਆਵਾਂ ਦਿੱਤੀਆਂ ਹਨ ਕਿਰਤ ਕਰੋ ਨਾਮ ਜਪੋ ਵੰਡ ਕੇ ਖ ਵੰਡ ਛਕੋ ਜਾਣੀ ਕਿ ਸਾਨੂੰ ਕਿਰਤ ਕਰਦੇ ਰਹਿਣਾ ਚਾਹੀਦਾ ਹੈ ਵਿਹਲੇ ਨਹੀਂ ਬੈਠਣਾ ਚਾਹੀਦਾ ਹਰ ਸਮੇਂ ਰੱਬ ਦਾ ਨਾਮ ਜਪਦਾ ਰਹਿਣਾ ਚਾਹੀਦਾ ਹੈ ਅਤੇ ਜੋ ਵੀ ਸਾਡੇ ਕੋਲ ਹੈ ਉਸ ਨੂੰ ਵੰਡ ਕੇ ਖਾਣਾ ਚਾਹੀਦਾ ਹੈ ਅਤੇ ਇਹ ਤਾਂ ਸਾਡੀ ਹੋਗੀਆਂ ਬੇਸਿਕ ਜਿਹੀਆਂ ਸਿੱਖਿਆਵਾਂ ਜਿਹੜੀਆਂ ਸਿੱਖ ਧਰਮ ਨਾਲ ਕੀਤੀਆਂ ਗਈਆਂ ਹਨ ਅਤੇ ਸਮਾਜ ਸੇਵਾ ਦੀ ਗੱਲ ਕੀਤੀ ਜਾਏ ਤਾਂ ਗੁਰੂ ਨਾਨਕ ਦੇਵ ਜੀ ਨੇ ਇੱਕ ਸੋਰੀ ਗੁਰੂਆਂ ਨੇ ਇੱਕ ਪ੍ਰਥਾ ਚਲਾਈ ਹੈ ਜਿਸ ਨੂੰ ਕਹਿੰਦੇ ਹੈ ਦਸ਼ਮੇਸ਼ ਜਾਨੀ ਕਿ ਸਾਨੂੰ ਆਪਣਾ ਕਮਾਈ ਦਾ ਦਸਵਾਂ ਹਿੱਸਾ ਜਿਹੜਾ ਹੈ ਉਹ ਕਿਸੇ ਚੰਗੇ ਕੰਮਾਂ ਵਿੱਚ ਦਾਨ ਕਰਨਾ ਚਾਹੀਦਾ ਹੈ ਅਤੇ ਮੈਂ ਕੀ ਕਰਦੀ ਹਾਂ ਆਪਣੀ ਕਮਾਈ ਦਾ ਦਸਵਾਂ ਹਿੱਸਾ ਗੁਰਦੁਆਰੇ ਵਿੱਚ ਦਾਨ ਕਰ ਦਿੰਦੀ ਹਾਂ ਜਿਵੇਂ ਕਿ ਗੁਰਦੁਆਰਿਆਂ ਵਿੱਚ ਚੌਵੀ ਘੰਟੇ ਲੰਗਰ ਲੱਗੇ ਹੁੰਦੇ ਹੈ ਫਰੀ ਲੰਗਰ ਲੱਗੇ ਹੁੰਦੇ ਹੈ ਉਹ ਅਤੇ ਜਿਹੜੇ ਜ਼ਰੂਰਤਮੰਦ ਲੋਕ ਹੁੰਦੇ ਹਨ ਭੁੱਖੇ ਲੋਕ ਹਨ ਹੁੰਦੇ ਹਨ ਉਹਨਾਂ ਨੂੰ ਉਹਨਾਂ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾਂਦਾ ਹੈ ਅਤੇ ਕਈ ਵਾਰ ਮੈਂ ਹੋਰ ਵੀ ਕਈ ਗਰੀਬ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਦੀ ਹਾਂ